ਹਾਂਜੀ ਭਾਰਤ ਦੇ ਵਿੱਚ ਬਹੁਤ ਸਾਰੇ ਵਪਾਰੀ ਉਦਯੋਗਪਤੀ ਅਤੇ ਨੇਤਾਵਾਂ ਨੇ ਆਪਣੇ ਜ਼ੋਰ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਭਾਰਤ ਨੂੰ ਬਦਲਿਆ ਹੈ ਅਤੇ ਇਸ ਇਸ ਦੇ ਸਿੱਖਿਆ ਪ੍ਰਣਾਲੀ ਦੇ ਪੱਧਰ ਨੂੰ ਵੀ ਬਹੁਤ ਹੀ ਉੱਚਾ ਕੀਤਾ ਹੈ ਅਤੇ ਨਾਲ ਦੀ ਨਾਲ ਇਸ ਦੇ ਇਸ ਨੂੰ ਵਪਾਰ ਵੱਲ ਵੀ ਬਹੁਤ ਵਧਾਇਆ ਹੈ ਇੱਥੇ ਹੁਣ ਆਵਾਜਾਈ ਦੇ ਸਾਧਨ ਵੀ ਬਹੁਤ ਜ਼ਿਆਦਾ ਮਿਲ ਜਾਂਦੇ ਹ ਇ ਬਹੁਤ ਜ਼ਿਆਦਾ ਮਿਲ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਿੱਖਿਆ ਪ੍ਰਣਾਲੀ ਚਲਾਈ ਹੈ ਕਿ ਜੋ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ ਉਹ ਇੱਕ ਕੁਆਲੀਫਾਇੰਗ ਪੇਪਰ ਹੋਵੇਗਾ ਇਸ ਲਈ ਉਹ ਜਿਸ ਨਾਲ ਉਹ ਆਪਣੀ ਸਿੱਖਿਆ ਪ੍ਰਣਾਲੀ ਨੂੰ ਪੰਜਾਬ ਦੇ ਵਿੱਚ ਉੱਚਾ ਚੁੱਕਣਾ ਚਾਹੁੰਦੇ ਹਨ ਮੈਨੂੰ ਲੱਗਦਾ ਇਹ ਉਨ੍ਹਾਂ ਦਾ ਇੱਕ ਬਹੁਤ ਵੱਡਾ ਬ ਬਹੁਤ ਵੱਡਾ ਯੋਗਦਾਨ ਹੈ